ਚੌਬੀ ਜਨਵਰੀ ਉੱਨੀ ਸੌ ਉਨਾਸੀ ਪੱਚੀ ਦਿਸੰਬਰ ਉੱਨੀ ਸੌ ਚੁਰਾਨਵੇਂ ਗਿਆਰਾਂ ਨਵੰਬਰ ਦੋ ਹਜ਼ਾਰ ਸਤਾਰਾਂ ਉਨੱਤੀ ਅਗਸਤ ਦੋ ਹਜ਼ਾਰ ਵੀਹ ਚੌਵੀ ਜਨਵਰੀ ਦੋ ਹਜ਼ਾਰ ਬਾਈ